ਪੰਜਾਬ ਵਿੱਚ ਇੰਝ ਤਾਂ ਕਈ ਯੂਨੀਵਰਸਿਟੀਆਂ ਹੈਗੀਆਂ ਹੈ ਮਗਰ ਸਭ ਤੋਂ ਪ੍ਰਚਲਿਤ ਜਿਹੜੀ ਹੈਗੀ ਹੈ ਪੰਜਾਬ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਹਨ ਤੁਹਾਨੂੰ ਇਸ ਦੇ ਰਿਲੇਟਿਡ ਕਈ ਕੋਲਜ ਵੀ ਮਿਲ ਜਾਣਗੇ ਜਿਵੇਂ ਬਿਆਲੀ ਦਾ ਕੋਲਜ ਹੋ ਗਿਆ ਡੀ ਏ ਵੀ ਕੋਲਜ ਹੋ ਗਿਆ ਖਾਲਸਾ ਕੋਲਜ ਹੋ ਗਿਆ ਇੱਥੇ ਉੱਚ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਇੱਥੇ ਹਰ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ ਜਿਸ ਵਿੱਚ ਤੁਸੀਂ ਹੱਥੀਂ ਕੰਮ ਤੋਂ ਲੈ ਕੇ ਤੁਸੀਂ ਨੂੰ ਅਸੀਂ ਸਕਿੱਲ ਡੇਵੇਲਪਮੇਂਟ ਵੀ ਕਹਿੰਦੇ ਹਾਂ ਉੱਚੇ ਕੰਮ ਤੋਂ ਲੈ ਕੇ ਉੱਚ ਸ਼ਿਕਸ਼ਾ ਵੀ ਲੈ ਸਕਦੇ ਹੋ